ਜਾਨਵਰਾਂ ਨੂੰ ਚਰਾਉਣ ਲਈ ਪਹਿਲਾਂ ਤਾਂ ਹਰੇ ਵਿਹੜੇ ਬਹੁਤ ਉਪਲੱਬਧ ਸਨ ਇਹ ਜਗ੍ਹਾ ਹੁਣ ਬਹੁਤ ਅਲੋਪ ਹੁੰਦੀਆਂ ਜਾ ਰਹੀਆਂ ਹਨ ਜਿਹਨਾਂ ਕਰਕੇ ਪਸ਼ੂਆਂ 'ਤੇ ਬਹੁਤ ਅਸਰ ਪੈਂਦਾ ਹੈ ਪਹਿਲਾਂ ਪਸ਼ੂ ਆਪਾਂ ਖੁੱਲ੍ਹੇ ਛੱਡਦੇ ਸੀ ਪਸ਼ੂ ਆਪਣੀ ਦੌੜ ਵਗੈਰਾ ਵੀ ਲਗਾ ਲੈਂਦੇ ਸੀ ਆਪਣੀ ਮਨਪਸੰਦ ਦਾ ਖਾਣਾ ਖਾ ਲੈਂਦੇ ਸੀ ਉਸ ਵਿੱਚੋਂ ਉਹਦੇ ਤਬਦੀਲੀਆਂ ਆਪਾਂ ਨੂੰ ਇਹ ਆਉਂਦੀਆਂ ਸਨ ਜਿਵੇਂ ਕਠੋਰ ਸੂਈ ਵਗੈਰਾ ਕਿਲ ਵਗੈਰਾ ਪਸ਼ੂ ਦੇ ਅੰਦਰ ਚਲਾ ਜਾਦਾ ਸੀ ਉਹ ਉਹਦੀ ਮੌਤ ਦਾ ਕਾਰਨ ਬਣਦਾ ਸੀ ਪਲਾਸਟਿਕ ਆਦਿ ਨਾਲ ਵੀ ਪਸ਼ੂਆਂ ਦੀ ਮੌਤ ਹੋ ਜਾਂਦੀ ਸੀ ਖੁੱਲ੍ਹੇ ਪਸ਼ੂ ਪਾਨ ਖੁੱਲ੍ਹੇ ਫਿਰਦੇ ਪਸ਼ੂ ਪਾਣੀ ਆ ਆਪਣੀ ਮੌਜ ਨਾਲ ਪਾਣੀ ਪੀ ਲਦੀ ਲੋੜ ਅਨੁਸਾਰ ਪਾਣੀ ਪੀ ਲੈਂਦੇ ਹਨ